ਹੈਲੋ ਦੀਦੀ ਮੈਂ ਬਾਹਰ ਜਾਣਾ ਪਲੱਸ ਟੂ ਕਰ ਲਈ ਆ ਮੈਂ ਕਿਹਾ ਮੈਂ ਬਾਹਰ ਜਾਣਾ ਪਲੱਸ ਟੂ ਕਰ ਲਈ ਹੁਣ ਮੈਂ ਹਾਂ ਹਾਂ ਪਾਸ ਹੋ ਗਿਆ ਹੁਣ ਮੈਨੂੰ ਭੇਜ ਦਿਓ ਬਾਹਰ ਅਤੇ ਇੱਕ ਵਾਰ ਆਪੇ ਬਾਹਰ ਜਾ ਕੇ ਸਿਖਲਾਂਗਾ ਜਾਂ ਕੋਈ ਕੋਈ ਨਾ ਕਿਹੜਾ ਕੰਮ ਸਿੱਖਾਂ ਫਿਰ ਚਲੋ ਕੋਈ ਨਹੀਂ ਮੈਂ ਪਹਿਲਾਂ ਪ ਪਤਾ ਕਰ ਲਵਾਂ ਮੇਰੇ ਨਾਲ ਦੇ ਦੋਸਤ ਵੀ ਚੱਲ ਗਏ ਸਾਰੇ ਬਾਹਰ ਚਲੋ ਕੋਈ ਨਹੀਂ ਫਿਰ ਦੇਖਦਾ ਫਿਰ ਮੈਂ ਕਰਦਾ ਕੰਮ ਠੀਕ ਹੈ ਚਲੋ ਠੀਕ ਹੈ ਸਿੱਖ ਲੈਂਦਾ ਫਿਰ ਚੰਗਾ